ਚੁਣੌਤੀਆਂ ਦਾ ਮੈਨੂੰ ਬਹੁਤ ਪਹਿਲਾਂ ਤੋਂ ਹੀ ਬਹੁਤ ਸ਼ੌਕ ਹੈ ਜਿੱਦਾਂ ਕਿ ਇਹਨੂੰ ਖਾਸ ਤੌਰ 'ਤੇ ਕੁਦਰਤੀ ਜਿੱਥੇ ਅਸੀਂ ਘੁੰਮਣਾ ਫਿਰਨਾ ਜਾਣਾ ਹੋਵੇ ਉਸ ਤਰ੍ਹਾਂ ਚੁਣੌਤੀਆਂ ਦਾ ਮੈਨੂੰ ਬੜਾ ਮਨ ਰਹਿੰਦਾ ਇਸ ਕਰਕੇ ਪਿਛਲੇ ਦਿਨ ਜਿਹੜਾ ਸ਼੍ਰੀ ਅਮਰਨਾਥ ਦਾ ਟਰੈਕ ਦਾ ਬਣਾਇਆ ਅਸੀਂ ਪ੍ਰੋਗਰਾਮ ਮੈਂ ਅਤੇ ਮੇਰੇ ਦੋ ਸਾਥੀਆਂ ਨੇ ਅਤੇ ਅਸੀਂ ਇੱਥੇ ਚਲ ਚਲ ਤਾਂ ਗਏ ਉਸ ਤੋਂ ਪਹਿਲਾਂ ਸਾਨੂੰ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਬਣਾਉਣਾ ਪਿਆ ਚਲੋ ਅਸੀਂ ਵਧੀਆ ਐਕਟਿਵ ਰਹੇ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਜਿੱਦਾਂ ਕਿ ਅਸੀਂ ਉੱਦਾਂ ਵੈਸੇ ਪ੍ਰੋਬਲਮ ਤਾਂ ਕੋਈ ਆਈ ਨਹੀਂ ਕੋਈ ਸਰਟੀਫਿਕੇਟ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਮੈਂ ਅਤੇ ਮੇਰੇ ਦੋਸਤ ਹਰਸ਼ ਅਤੇ ਜੱਸੀ ਦੋਨੇ ਚਲੇ ਗਏ ਤਿੰਨੇ ਚਲੇ ਗਏ ਅਤੇ ਅਸੀਂ ਜਿੱਦਾਂ ਹੀ ਸਟਾਰਟ ਕੀਤਾ ਟਰੈਕ ਤਾਂ ਸਾਨੂੰ ਲੱਗਿਆ ਚਲੋ ਈਜ਼ੀ ਹੋਣਾ ਸੌਖਾ ਹੀ ਹੋਣਾ ਪਰ ਜਿੱਦਾਂ ਜਿੱਦਾਂ ਅਸੀਂ ਚੜ੍ਹਾਈ ਚੜ੍ਹਦੇ ਗਏ ਪਹਿਲਾਂ ਪਹਿਲਾਂ ਰਸਤਾ ਬੜਾ ਚੌੜਾ ਸੀ ਅਤੇ ਉੱਥੇ ਚੁਣੌਤੀਆਂ ਇਹ ਸਨ ਕਿ ਰਸਤਾ ਹੌਲੀ ਹੌਲੀ ਟ ਟਾਈਟ ਹੁੰਦਾ ਗਿਆ ਬਹੁਤ ਜ਼ਿਆਦਾ ਸੰਕਰਾ ਹੋ ਹੋਈ ਗਿਆ ਅਤੇ ਜਿਸ ਤਰ੍ਹਾਂ ਕਿ ਉੱਥੇ ਲੰਘਣਾ ਬੜਾ ਔਖਾ ਤਾ ਜਿਹੜੇ ਟਰੈਕ ਹੈ ਪਹਿਲਾਂ ਪਹਿਲਾਂ ਸਮਿੰਟਿਡ ਸੀ ਬਾਅਦ ਵਿੱਚ ਪੱਥਰਾਂ ਦਾ ਆ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਚੁਣੌਤੀਆਂ ਇਹ ਆਈਆਂ ਕਿ ਟਰੈਕ ਪੱਥਰਾਂ ਦਾ ਵੀ ਨਹੀਂ ਰਿਹਾ ਛੋਟੇ ਛੋਟੇ ਕੰਕਰਾਂ ਦਾ ਜਿੱਦਾਂ ਕਿ ਜੰਗਲ ਦੇ ਵਿੱਚ ਗੋਹਰੀਆਂ ਪੱਥਰ ਦੇ ਵੀ ਬਣਿਆ ਕੋਈ ਮਤਲਬ ਪੌੜੀਨੁਮਾ ਕੁਛ ਨਹੀਂ ਬਣਾਇਆ ਹੋਇਆ ਸੀ ਅਤੇ ਉਹਨਾਂ ਚਲੋ ਚੁਣੌਤੀਆਂ ਤਾਂ ਬਹੁਤ ਸਨ ਪਰ ਸਾਡਾ ਤਾਂ ਦਿਲ ਹਾਰ ਚੁੱਕਿਆ ਸੀ ਪਰ ਫੇਰ ਵੀ ਸਾਨੂੰ ਸਾਡੇ ਗਾਈਡ ਨੇ ਸਾਨੂੰ ਬੜਾ ਮੋਟੀਵੇਟ ਕੀਤਾ ਕਿ ਕੋਈ ਗੱਲ ਨਹੀਂ ਚਲੋ ਫਿਰ ਵੀ ਉਹ ਰਸਤੇ ਵਿੱਚ ਬ ਚੁਣੌਤੀ ਇੱਕ ਹੋਰ ਆਈ ਬਾਰਿਸ਼ ਪੈ ਗਈ ਬਾਰਿਸ਼ ਪੈਣ ਹਰੇਕ ਰਸਤਾ ਤਿਲਕਣ ਭਰਿਆ ਹੋ ਗਿਆ ਥੋੜ੍ਹੇ ਟਾਈਮ ਸਾਨੂੰ ਰੁਕਣਾ ਪਿਆ ਚਲੋ ਫੇਰ ਅੱਗੇ ਜਾ ਕੇ ਰਸਤਾ ਤਾਂ ਵਧੀਆ ਮਿਲ ਗਿਆ ਜਿਸ ਕਰਕੇ ਅਸੀਂ ਧੁਰ ਅਮਰਨਾਥ ਜੀ ਤੱਕ ਪਹੁੰਚ ਗਏ ਅਤੇ ਇਹ ਬੜਾ ਚੁਣੌਤੀਪੂਰਨ ਬੜਾ ਆਨੰਦਮਈ ਸਫਲਤਾ ਹੁਣ ਤਾਂ ਮੈਂ ਇੱਦਾਂ ਹੋ ਗਿਆ ਕਿ ਕਿਤੇ ਵੀ ਜਾ ਸਕਦਾ